ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਘੁੰਮਣਾ ਮੈਨੂੰ ਚੰਗਾ ਸਮਝਦਾ ਹਾਂ ਅਤੇ ਅਲੱਗ ਅਲੱਗ ਇਹਨਾਂ ਦੋਨਾਂ ਦਾ ਮਜ਼ਾ ਹੈ ਜਿੱਦਾਂ ਹੁਣ ਆਪਣੇ ਪਰਿਵਾਰ ਨਾਲ ਘੁੰਮਣਾ ਹੋਇਆ ਉਹਦੇ ਨਾਲ ਆਪਾਂ ਕਿਤੇ ਘੁੰਮਣ ਚਲੇ ਗਏ ਕਿਸੇ ਵਧੀਆ ਜਗ੍ਹਾ 'ਤੇ ਚਲੇ ਗਏ ਤਾਂ ਜੋ ਪਰਿਵਾਰ ਨੂੰ ਇੱਕ ਤਾਂ ਸੰਤੁਸ਼ਟੀ ਮਿਲਦੀ ਹੈ ਨਾਲੇ ਪਰਿਵਾਰ ਨਾਲ ਆਪਾਂ ਟੈਮ ਬਿਤਾ ਸਕਦੇ ਇਸ ਤਰ੍ਹਾਂ ਅਤੇ ਪਰਿਵਾਰ ਨੂੰ ਕੇ ਹਾਂਜੀ ਸਾਡੇ ਪਰਿਵਾਰ ਨੇ ਘਰ ਦੇ ਜੀਅ ਨੇ ਸਾਡੇ ਨਾਲ ਟੈਮ ਸਮਾਂ ਸਮਾਂ ਬਤੀਤ ਕੀਤਾ ਅਤੇ ਉਹਨੇ ਦਿਮਾਗ ਉਹ ਵੀ ਵਧੀਆ ਹੋ ਜਾਂਦਾ ਇਸ ਤਰ੍ਹਾਂ ਅਤੇ ਦੋਸਤ ਦੇ ਨਾਲ ਵੀ ਆਪਾਂ ਇੱਕ ਵਧੀਆ ਜਗ੍ਹਾ 'ਤੇ ਘੁੰਮਣ ਜਾਂਦੇ ਹਾਂ ਜੋ ਉਹਨਾਂ ਨਾਲ ਅਲੱਗ ਮਜ਼ਾ ਆਉਂਦਾ ਉੱਥੇ ਕਿਤੇ ਬਹਿ ਕੇ ਪਾਰਟੀ ਕਰ ਲਈ ਹਾਸਾ ਮਜ਼ਾਕ ਕਰ ਲਿਆ ਇੱਕ ਦੂਜੇ ਨੂੰ ਕਿਤੇ ਆਪਣਾ ਧੱਕੇ ਮਾਰ ਲਏ ਕਿਤੇ ਪਿਆਰ ਕਰ ਲਿਆ ਇੱਕ ਦੂਜੇ ਨੂੰ ਉਹਨਾਂ ਨਾਲ ਵੀ ਅਲੱਗ ਮਜ਼ਾ ਹੈਗਾ ਵੈਸੇ ਦੋਸਤ ਅਤੇ ਪਰਿਵਾਰ ਦਾ ਦੋਨਾਂ ਚੀਜ਼ਾਂ ਦਾ ਮਜ਼ਾ ਆਪਾਂ ਨੂੰ ਅਲੱਗ ਅਲੱਗ ਹੀ ਆਊਗਾ ਦੋਸਤ ਦੇ ਨਾਲ ਆਪਾਂ ਕਿਤੇ ਪਹਾੜੀਆਂ 'ਤੇ ਘੁੰਮਣ ਚਲੇ ਗਏ ਉਹਨਾਂ ਨਾਲ ਉਸ ਤਰ੍ਹਾਂ ਨਾਲ ਆਪਾਂ ਗੱਲਾਂ ਬਾਤਾਂ ਕਰੀਆਂ ਪਰਿਵਾਰ ਨਾਲ ਆਪਾਂ ਅਲੱਗ ਤਰ੍ਹਾਂ ਗੱਲਾਂ ਬਾਤਾਂ ਕਰੀਆਂ ਕਿਉਂਕਿ ਪਰਿਵਾਰ ਨਾਲ ਅਲੱਗ ਗੱਲਾਂ ਕਰ ਸਕਦੇ ਹਾਂ ਦੋਸਤਾਂ ਨਾਲ ਆਪਾਂ ਅਲੱਗ ਗੱਲ ਗੱਲ ਕਰ ਸਕਦੇ ਹਾਂ ਇਸ ਤਰ੍ਹਾਂ ਦੋਸਤ ਅਤੇ ਪਰਿਵਾਰ ਨਾਲ ਘੁੰਮਣ ਦਾ ਮਜ਼ਾ ਵੀ ਅਲੱਗ ਅਲੱਗ ਹੀ ਆਉਂਦਾ ਹੈ